ਪੰਜਾਬ ਵਿੱਚ ਸਿੱਖਿਆ ਖੇਤਰ ਦੇ ਰੁਝਾਨਾਂ ਦੇ ਵਿੱਚ ਗੱਲ ਇਹ ਹੈ ਵੀ ਪਹਿਲੇ ਤਾਂ ਪੰਜਾਬ ਦੇ ਵਿੱਚ ਬੱਚੇ ਜਿਹੜੇ ਹੁੰਦੇ ਸੀ ਅਤੇ ਉਹ ਪੜ੍ਹਨ ਦੇ ਵਿੱਚ ਕੁਝ ਮਾਹਿਰ ਹੁੰਦੇ ਸੀ ਕੁਝ ਨਲਾਇਕ ਵੀ ਮਿਲਦੇ ਸਨ ਅਤੇ ਹੁਣ ਰੁਝਾਨ ਇਹ ਆ ਗਿਆ ਵੀ ਬੱਚੇ ਨੂੰ ਪੜ੍ਹਾਉਣਾ ਫੇਲ੍ਹ ਨਹੀਂ ਕਰਨਾ ਪਰ ਫੇਲ੍ਹ ਤਾਂ ਹੋਊਗਾ ਹੀ ਜਦੋਂ ਉਹਨੇ ਪੜ੍ਹਨਾ ਨਹੀਂ ਹੈਗਾ ਪਰ ਹੁਣ ਫੇਰ ਬਦਲ ਗਿਆ ਰੁਝਾਨ ਮੁੜਕੇ ਪਹਿਲੇ ਵਾਲਾ ਹੀ ਹੁਣ ਵਾਲਾ ਨਵਾਂ ਰੁਝਾਨ ਜਿਹੜਾ ਸ਼ੂਰੁ ਹੋਇਆ ਹੋਇਆ ਅਤੇ ਬੱਚੇ ਪੜ੍ਹਦੇ ਤਾਂ ਹੈ ਨਹੀਂ ਜੇ ਪੜ੍ਹਾਈ ਵੱਲ ਨੂੰ ਦੇਖਦੇ ਹਾਂ ਤਾਂ ਬੱਚੇ ਨੂੰ ਅੱਠਵੀਂ ਤੱਕ ਤਾਂ ਫੇਲ ਹੀ ਨਹੀਂ ਕਰਨਾ ਇਹ ਮੁੱਖ ਰੁਝਾਨ ਆ ਗਿਆ ਇਹਦੇ ਵਿੱਚ ਬੱਚਿਆਂ ਦਾ ਕੈਰੀਅਰ ਅਤੇ ਆਉਣ ਵਾਲਾ ਜਿਹੜਾ ਭਵਿੱਖ ਹੈ ਉਹ ਜ਼ੀਰੋ ਹੋ ਸਕਦਾ ਹੈ